ਸਤਿ ਸ਼੍ਰੀ ਅਕਾਲ ਜੀ ਜੇਕਰ ਗੱਲ ਕੀਤੀ ਜਾਵੇ ਕੁਝ ਲਿਖਣ ਦੀ ਤਾਂ ਮੈਨੂੰ ਬਚਪਨ ਤੋਂ ਹੀ ਲਿਖਣ ਦਾ ਕਾਫ਼ੀ ਸ਼ੌਕ ਹੈ ਮੈਂ ਆਪਣੇ ਬਚਪਨ ਵਿੱਚ ਹੀ ਕਾਫ਼ੀ ਲਿਖਣਾ ਪੜ੍ਹਨਾ ਚਾਹੁੰਦੀ ਸੀ ਅਤੇ ਕਦੀ ਕਦੀ ਮੇਰਾ ਮਨ ਕਰਦਾ ਹੈ ਕਿ ਮੈਂ ਕਿਸੇ ਵਿਸ਼ੇ ਦੇ ਉੱਪਰ ਕੁਝ ਲਿਖਾਂ ਪਰ ਪਰ ਉਸ ਉੱਤੇ ਕੁਝ ਪਾਬੰਦੀਆਂ ਹੁੰਦੀਆਂ ਹਨ ਅਤੇ ਉਹ ਚੀਜ਼ਾਂ ਵਰਜਿਤ ਹੁੰਦੀਆਂ ਹਨ ਅਤੇ ਮੈਂ ਉਹ ਚੀਜ਼ਾਂ ਨੂੰ ਨਹੀਂ ਲਿਖ ਪਾਉਂਦੀ ਪਰ ਮੈਨੂੰ ਕਦੇ ਕਦੇ ਅਜਿਹੇ ਵਿਸ਼ੇ ਮਿਲ ਜਾਂਦੇ ਹਨ ਜਿਨ੍ਹਾਂ ਬਾਰੇ ਮੈਂ ਪੂਰੇ ਵਿਸ਼ਵਾਸ ਅਤੇ ਪ੍ਰਮੁੱਖ ਦੌਰਾਨ ਮੈਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਇਹ ਲਿਖ ਸਕਦੀ ਹਾਂ ਪਰ ਇਸ ਤਰ੍ਹਾਂ ਦੇ ਸਿੱਧਾਂ ਸ਼ੱਕਾਂ ਤਰਜੀਹਾਂ ਅਤੇ ਸਾਹਤਿਕ ਵਿੰਧ ਵਿਚਾਰ ਧਿਰਾਵਾਂ ਧਿਰਾਵਾਂ ਬਾਰੇ ਵਿੱਚ ਅਲੱਗ ਅਲੱਗ ਦੇਸ਼ਾਂ ਅਤੇ ਸਮਾਜਾਂ ਵਿੱਚ ਪ੍ਰਭਾਵ ਪੈ ਸਕਦੇ ਹਨ ਜੇਕਰ ਮੈਂ ਕੁਝ ਲਿਖ ਰਹੀ ਹਾਂ ਤਾਂ ਮੇਰੇ ਹਿਸਾਬ ਨਾਲ਼ ਤਾਂ ਉਹ ਠੀਕ ਹੀ ਹੋਵੇਗਾ ਪਰ ਉਹ ਅੱਗੇ ਤਾਂ ਜ਼ਰੂਰ ਜਾਵੇਗਾ ਅਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਅੱਗੇ ਜਾ ਕੇ ਲੜਾਈ ਝਗੜੇ ਦਾ ਵਿਸ਼ਾ ਨਾ ਬਣ ਬਣ ਜਾਵੇ ਤਾਂ ਇਸ ਕਰਕੇ ਮੈਨੂੰ ਕਦੇ ਕਦੇ ਹੁੰਦਾ ਹੈ ਕਿ ਮੇਰੇ ਮਨ ਵਿੱਚ ਲਿਖਣ ਦਾ ਖਿਆਲ ਆ ਰਹੇ ਰਹੇ ਹਨ ਮੈਂ ਲਿਖਣਾ ਵੀ ਚਾਹੁੰਦੀ ਹਾਂ ਤਾਂ ਪਰ ਲਿਖ ਨਹੀਂ ਪਾਉਂਦੀ ਕਿਉਂਕਿ ਜੇਕਰ ਮੈਂ ਇਸ ਉੱਪਰ ਲਿਖਾਂਗੀ ਤਾਂ ਉਹ ਗਲਤ ਨਾ ਹੋ ਜਾਵੇ ਇਸ ਕਰਕੇ ਮੇਰੇ ਵਿੱਚ ਇਹ ਉਹ ਖਿਆਲ ਲਿਖਣ ਦੀ ਹਿੰਮਤ ਨਹੀਂ ਪੈਂਦੀ ਧੰਨਵਾਦ ਜੀ